ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਅਸੀਂ ਆਪਣੇ ਘਰ ਵਿੱਚ ਪੀਣ ਵਾਲੀਆਂ ਚੀਜ਼ਾਂ ਗਰਮੀਆਂ ਦੀਆਂ ਜਿਸ ਤਰ੍ਹਾਂ ਕਿ ਨਿੰਬੂ ਪਾਣੀ ਬਣਾਉਂਦੇ ਹਾਂ ਉਹ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਸ ਤੋਂ ਇਲਾਵਾ ਗਰਮੀਆਂ ਵਿੱਚ ਅਸੀਂ ਬਨਾਨਾ ਸ਼ੇਕ ਵੀ ਘਰ ਬਣਾ ਲੈਂਦੇ ਬੱਚੇ ਖੁਦ ਜਦ ਪੀਣ ਨੂੰ ਦਿਲ ਕਰੇ ਉਹ ਬਣਾ ਲੈਂਦੇ ਆ ਜਾਂ ਫਿਰ ਮੈਂਗੋ ਜਿਸ ਤਰ੍ਹਾਂ ਉਹ ਮੈਂਗੋ ਸ਼ੇਕ ਵੀ ਬੱਚੇ ਬਣਾ ਲੈਂਦੇ ਆ ਖੁਸ਼ ਹੋ ਕੇ ਉਹ ਵੀ ਬਹੁਤ ਜ਼ਿਆਦਾ ਬੱਚੇ ਪਸੰਦ ਕਰਦੇ ਆ ਟੇਸਟ ਹੁੰਦਾ ਮੈਂਗੋ ਸ਼ੇਕ ਵੀ ਔਰ ਜਿਸ ਤਰ੍ਹਾਂ ਕਿ ਹਦਵਾਣੇ ਦੀ ਬਹਾਰ ਆ ਜਾਂਦੀ ਹੈ ਤਾਂ ਫਿਰ ਬੱਚੇ ਵਾਟਰਮਿਲਨ ਜਿਸ ਤਰ੍ਹਾਂ ਉਹ ਵੀ ਬਣਾਉਣਾ ਪਸੰਦ ਕਰਦੇ ਆ ਸ਼ੇਕ ਬਣਾਉਣਾ ਵਾਟਰਮਿਲਨ ਦਾ ਸ਼ੇਕ ਵੀ ਬਣਾ ਲੈਂਦੇ ਬਹੁਤ ਖੁਸ਼ ਹੋ ਕੇ ਔਰ ਇਸ ਤਰ੍ਹਾਂ ਕੱਚੀ ਲੱਸੀ ਫਿਰ ਕਈ ਵਾਰ ਲੱਸੀ ਜਿਹੜੀ ਦਹੀਂ ਨੂੰ ਰਿੜਕ ਕੇ ਉਹਦੀ ਲੱਸੀ ਵੀ ਬਣਾ ਲੈਂਦੇ ਪੀਣ ਵਾਲੀ ਬਹੁਤ ਵਧੀਆ ਲੱਗਦਾ ਕਈ ਵਾਰ ਬੱਚੇ ਬਜ਼ਾਰ ਕੋਲਡ ਡਰਿੰਕ ਹੈ ਜਾਂ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਬਣਾਉਂਦੇ ਆ ਬਹੁਤ ਵਧੀਆ ਲੱਗਦਾ ਗਰਮੀਆਂ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪੀਣ ਨੂੰ ਔਰ ਸਿਹਤ ਲਈ ਬਹੁਤ ਵਧੀਆ ਨੇ